ਸਾਡੇ ਇਲਾਕੇ ਵਿੱਚ ਆਮਦਨ ਦੇ ਕਈ ਸਾਧਨ ਹਨ ਪਿੰਡਾਂ ਦੇ ਲੋਕ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਧੰਦਾ ਕਰਦੇ ਹਨ ਇਸ ਨਾਲ਼ ਉਹ ਕਾਫ਼ੀ ਧੰਨ ਇਕੱਤਰ ਕਰ ਲੈਂਦੇ ਹਨ ਸ਼ਹਿਰਾਂ ਦੇ ਲੋਕ ਕਰਿਆਨੇ ਅਤੇ ਕੱਪੜਿਆਂ ਦੀਆਂ ਦੁਕਾਨਾਂ ਚਲਾਉਂਦੇ ਹਨ ਕਈ ਲੋਕਾਂ ਨੇ ਆਪਣੇ ਘਰਾਂ ਨੂੰ ਹੋਮ ਸਟੇਅ ਵੀ ਬਣਾਇਆ ਹੋਇਆ ਹੈ ਜਿਸ ਨਾਲ਼ ਬਾਹਰ ਦੇ ਲੋਕ ਆਉਂਦੇ ਹਨ ਅਤੇ ਉਹਨਾਂ ਘਰਾਂ ਵਿੱਚ ਰਹਿੰਦੇ ਹਨ ਇਸ ਨਾਲ਼ ਲੋਕਾਂ ਨੂੰ ਧੰਨ ਕਮਾਉਣ ਦਾ ਇੱਕ ਬਹੁਤ ਹੀ ਜ਼ਿਆਦਾ ਵਧੀਆ ਸਾਧਨ ਮਿਲ ਜਾਂਦਾ ਹੈ ਸਾਡੇ ਇਲਾਕੇ ਵਿੱਚ ਕਈ ਪ੍ਰਕਾਰ ਦੀਆਂ ਫੈਕਟਰੀਆਂ ਵੀ ਖੁੱਲ੍ਹੀਆਂ ਹੋਈਆਂ ਹਨ ਜੋ ਕਿ ਮਜ਼ਦੂਰਾਂ ਨੂੰ ਇੱਕ ਰੁਜ਼ਗਾਰ ਦਾ ਸਾਧਨ ਪ੍ਰਾਪਤ ਕਰਦੇ ਹਨ